ਦੇਖਣ ਲਈ ਮੇਰੀ ਮਨਪਸੰਦ ਥਾਵਾਂ ਕੁਰੂਕਸ਼ੇਤਰ ਜੋਧਪੁਰ ਚੰਡੀਗੜ੍ਹ ਨੈਨਾ ਦੇਵੀ ਵੈਸ਼ਨੋ ਦੇਵੀ ਹਨ ਅਤੇ ਹੁਣ ਜੇ ਮੈਂ ਗੱਲ ਕਰਾਂ ਪਸੰਦ ਦੀ ਤਾਂ ਕੁਰੂਕਸ਼ੇਤਰ ਪਸੰਦ ਹੈ ਮੈਨੂੰ ਇੱਕ ਤਾਂ ਧਾਰਮਿਕ ਸਥੱਲ ਹੈ ਉੱਥੇ ਸਾਨੂੰ ਆਪਣੇ ਇਤਿਹਾਸ ਬਾਰੇ ਧਰਮ ਬਾਰੇ ਬਹੁਤ ਵਧੀਆ ਜਾਣਕਾਰੀ ਮਿਲਦੀ ਹੈ ਪੈਨੋਰਾਮਾ ਹੈਗਾ ਉੱਥੇ ਮਿਊਜ਼ੀਅਮ ਹੈ ਅਤੇ ਬਹੁਤ ਸਾਰੇ ਮੰਦਰ ਹੈ ਗੁਰਦੁਆਰੇ ਹਨ ਜਿੱਥੇ ਅਸੀਂ ਘੁੰਮ ਸਕਦੇ ਹੈ ਬੜੀ ਸ਼ਾਂਤੀ ਮਿਲਦੀ ਹੈ ਬੜਾ ਹੀ ਨਾ ਸ਼ਾਂਤੀ ਵਾਲਾ ਵਾਤਾਵਰਨ ਹੈ ਉੱਥੇ ਸਾਰਾ ਹੀ ਜੋਧਪੁਰ ਗਈ ਸੀ ਮੈਂ ਮੈਨੂੰ ਉਹ ਜਗ੍ਹਾ ਬਹੁਤ ਪਸੰਦ ਹੈ ਉੱਥੇ ਸਾਰਾ ਇਤਿਹਾਸ ਰਾਜੇ ਮਹਾਰਾਜੇ ਕਿੱਦਾਂ ਰਹਿੰਦੇ ਸੀ ਵੱਡੇ ਵੱਡੇ ਕਿਲੇ ਮਹਿਲ ਔਰ ਇੰਨੀ ਜ਼ਿਆਦਾ ਸਫਾਈ ਉੱਥੇ ਰਾਜਸਥਾਨ 'ਚ ਜੋਧਪੁਰ ਚ ਬਹੁਤ ਗਰਮੀ ਹੁੰਦੀ ਹੈ ਪਰ ਉੱਥੇ ਸਾਨੂੰ ਗਰਮੀ ਦੇ ਵਿੱਚ ਵੀ ਘੁੰਮਦੇ ਹੋਏ ਉਹਦਾ ਅਹਿਸਾਸ ਨਹੀਂ ਰਿਹਾ ਥਾਂ ਥਾਂ 'ਤੇ ਪੀਣ ਨੂੰ ਪਾਣੀ ਮਿਲਿਆ ਠੰਡਾ ਪਾਣੀ ਐਨ ਸਾਫ਼ ਸਫ਼ਾਈ ਮਿਲੀ ਕਿ ਘੁੰਮਦੇ ਹੋਏ ਵੀ ਉੱਥੇ ਨਜ਼ਾਰਾ ਆ ਗਿਆ ਅਤੇ ਫੇਰ ਮੈਨੂੰ ਹੁਣ ਚੰਡੀਗੜ੍ਹ ਪਸੰਦ ਹੈ ਚੰਡੀਗੜ੍ਹ ਉਹ ਸਿਟੀ ਹੈ ਜਿੱਥੇ ਅਸੀਂ ਵਧੀਆ ਤਰੀਕੇ ਨਾਲ ਘੁੰਮ ਫਿਰ ਸਕਦੇ ਹਾਂ ਕੋਈ ਸ਼ੋਪਿੰਗ ਕਰਨੀ ਹੋਵੇ ਕਰ ਸਕਦੇ ਹੈ ਬੱਚਿਆਂ ਨਾਲ ਘੁੰਮਣ ਜਾਣਾ ਹੈ ਤਾਂ ਉੱਥੇ ਪਾਰਕ ਹੈਗੇ ਹੈ ਰੌਕ ਗਾਰਡਨ ਹੈਗਾ ਹੈ ਝੀਲ ਹੈਗੀ ਹੈ ਅਤੇ ਹੁਣ ਉਹਨਾਂ ਨੇ ਇੱਕ ਹੋਰ ਜਿਹੜਾ ਬਰਡ ਪਾਰਕ ਬਣਾਇਆ ਨਾ ਉਹ ਵੀ ਬਹੁਤ ਵਧੀਆ ਬਣਿਆ ਉੱਥੇ ਤਾਂ ਇਹ ਸਭ ਚੀਜ਼ਾਂ ਸਾਨੂੰ ਘੁੰਮਣ ਫਿਰਨ ਲਈ ਬੱਚਿਆਂ ਨੂੰ ਘੁੰਮਾਉਣ ਵਾਸਤੇ ਬਹੁਤ ਲੱਗਦੀਆਂ ਅਤੇ ਨੈਣਾ ਦੇਵੀ ਜਾਉ ਵੈਸ਼ਨੋ ਦੇਵੀ ਜਾਉ ਮਾਤਾ ਦੇ ਦਰਸ਼ਨ ਕਰੋ ਮਨ ਦੇ ਵਿੱਚ ਜਿਹੜਾ ਧਰਮ ਦੇ ਪ੍ਰਤੀ ਆਪਣੀ ਆਸਥਾ ਹੁੰਦੀ ਹੈ ਉਹ ਵਧਦੀ ਹੈ ਅਤੇ ਇਸ ਲਈ ਮੈਨੂੰ ਆਹ ਸਾਰੀਆਂ ਚੀਜ਼ਾਂ ਬਹੁਤ ਪਸੰਦ ਹੈ